ਚੌਦਾਂ ਦਸੰਬ ਉੱਨੀ ਸੌ ਬਾਨਵੇਂ ਸਤਾਈ ਜਨਵਰੀ ਉੱਨੀ ਸੌ ਚੁਰਾਨਵੇਂ ਪੰਦਰਾਂ ਅਗਸਤ ਦੋ ਹਜ਼ਾਰ ਅਠਾਰਾਂ ਛੱਬੀ ਦਸੰਬਰ ਦੋ ਹਜ਼ਾਰ ਨੌ ਪੰਜ ਜੁਲਾਈ ਦੋ ਹਜ਼ਾਰ